ਗੱਤਕੇ ਵਿੱਚ ਖ਼ਾਸ ਧਿਆਨ ਵਰਤੇ ਜਾਂਦੇ ਹਨ ਗੱਤਕਾ ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਲਾਇਆ ਸੀ

ਗੱਤਕਾ ਖੇਡਣ ਲਈ ਸਾਨੂੰ ਮਾਨਸਿਕ ਅਤੇ ਸਰੀਰਿਕ ਦੋਨਾਂ ਪਾਸਿਆਂ ਤੋਂ ਤੰਦਰੁਸਤ ਹੋਣਾ ਚਾਹੀਦਾ ਹੈ ਗੱਤਕਾ ਖੇਡਣ ਲਈ ਸਾਨੂੰ ਬਹੁਤ ਸਾਰੇ ਹਥਿਆਰ ਵਰਤੇ ਜਾਂਦੇ ਹਨ ਜਿਸ ਵਿੱਚ ਡੰਡਾ ਸੋਟੀ ਤਲਵਾਰ ਖੰਡਾ ਢਾਲ ਆਮ ਤੌਰ 'ਤੇ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਡੰਡੇ ਦੀ ਵਰਤੋਂ ਅਸੀਂ ਹਮਲਾ ਕਰਨ ਲਈ ਤਲਵਾਰ ਦੀ ਵਰਤੋਂ ਵੀ ਅਸੀਂ ਹਮਲਾ ਕਰਨ ਲਈ ਵਰਤਦੇ ਹਾਂ ਅਤੇ ਢਾਲ ਦੀ ਵਰਤੋਂ ਅਸੀਂ ਹਮਲੇ ਨੂੰ ਰੋਕਣ ਲਈ ਕਰਦੇ ਹਾਂ ਗੱਤਕਾ ਖ਼ਾਸ ਤੌਰ 'ਤੇ ਜੰਗ ਦੇ ਮੈਦਾਨਾਂ ਵਿੱਚ ਜਾਂ ਆਮ ਤੌਰ 'ਤੇ ਨਗਰ ਕੀਰਤਨਾਂ ਵਿੱਚ ਖੇਡਿਆ ਜਾਂਦਾ ਹੈ ਇਸ ਵਿੱਚ ਔਰਤਾਂ ਮਰਦ ਨੌਜਵਾਨ ਬਜ਼ੁਰਗ ਬੱਚੇ ਸਾਰੇ ਖੇਡ ਸਕਦੇ ਹਨ ਇਸ ਲਈ ਸਾਨੂੰ ਮੁੱਖ ਤੌਰ 'ਤੇ ਸਿੱਖਿਆ ਲੈਣੀ ਪੈਂਦੀ ਹੈ ਜਿਸ ਨੂੰ ਗੱਤਕੇ ਦੀ ਸਿੱਖਿਆ ਕਿਹਾ ਜਾਂਦਾ ਹੈ ਗੱਤਕੇ ਵਿੱਚ ਬਹੁਤ ਸਾਰੇ ਹਥਿਆਰ ਜਿਸ ਤਰ੍ਹਾਂ ਮੈਂ ਦੱਸਿਆ ਹੈ ਵਰਤੇ ਜਾਂਦੇ ਹਨ ਇਹਨਾਂ ਹਥਿਆਰਾਂ ਦੀ ਮੁੱਖ ਸਿੱਖਿਆ ਹੁੰਦੀ ਹੈ ਵਰਤਣ ਲਈ ਚਲਾਉਣ ਲਈ ਮੁੱਖ ਤੌਰ 'ਤੇ ਸਾਨੂੰ ਦੱਸਿਆ ਜਾਂਦਾ ਹੈ ਗੱਤਕੇ ਵਿੱਚ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ ਇਸ ਇਹ ਗੱਤਕਾ ਨਿਹੰਗ ਸਿੰਘ ਆਮ ਤੌਰ 'ਤੇ ਖੇਡਦੇ ਹਨ ਅਤੇ ਆਪਣੇ ਨਾਲ ਵੀ ਤਲਵਾਰਾਂ ਰੱਖਦੇ ਹਨ ਇਹ ਸਾਨੂੰ ਸੁਰੱਖਿਆ ਵੀ ਪ੍ਰਦਾਨ ਕਰਦਾ ਹੈ ਅਤੇ ਸਾਡੇ ਵਿੱਚ ਆਤਮ ਸ਼ਕਤੀ ਵੀ ਪ੍ਰਦਾਨ ਕਰਦਾ ਹੈ ਧੰਨਵਾਦ